ਇੱਕ ਕਲਾਕਾਰ ਆਪਣਾ ਕਲਾ ਨੂੰ ਦਿਖਾਉਣ ਵਾਸਤੇ ਆਪਣੇ ਅੰਦਰੂਨੀ ਅ ਸੋਚ ਨੂੰ ਦੇਖ ਕੇ ਫੇਰ ਬਣਾਉਂਦਾ ਹੈ ਉਹ ਕੁੱਛ ਦਿਮਾਗ ਵਿੱਚ ਸੋਚਦਾ ਨਹੀਂ ਹੈ ਜੋ ਉਹ ਦੇ ਦਿਲ ਵਿੱਚ ਹੁੰਦਾ ਉਹਨੂੰ ਆਪਣੀ ਕਲਾ ਦੇ ਰੂਪ ਵਿੱਚ ਲੋਕਾਂ ਨੂੰ ਦਰਸਾਉਂਦਾ ਹੈ ਅਗਰ ਅਸੀਂ ਮੰਦਰ ਵਿੱਚ ਮੂਰਤੀਆਂ ਦੀ ਗੱਲ ਕਰੀਏ ਤੋ ਉਹ ਆਮ ਮੂਰਤੀ ਨਹੀਂ ਹੁੰਦੀ ਇੱਕ ਕਲਾਕਾਰ ਦੀ ਅੰਦਰੂਨੀ ਭਾਵਨਾ ਹੁੰਦੀ ਹੈ ਜੋ ਆਮ ਲੋਕਾਂ ਤੱਕ ਦਰਸਾਈ ਜਾਂਦੀ ਹੈ